ਸਤਿ ਸ਼੍ਰੀ ਅਕਾਲ ਬਾਈ ਜੀ ਜਮੈਟੋ 'ਚੋਂ ਜੈਲੀ ਬੋਲਦੇ ਹੋਂ ਮੈਂ ਦਸ ਮਿੰਟ ਪਹਿਲਾਂ ਤੁਹਾਡੇ ਕੋਲ ਇੱਕ ਆਡਰ ਬੁੱਕ ਕੀਤਾ ਸੀ ਜਿਸ ਵਿੱਚ ਮੈਂ ਇੱਕ ਪੀਜ਼ਾ ਆਡਰ ਕੀਤਾ ਸੀ ਪਰ ਹੁਣ ਮੈਂ ਆਡਰ ਵਿੱਚ ਕੁਝ ਹੋਰ ਚੀਜ਼ਾਂ ਵੀ ਐਡ ਕਰਵਾਉਣਾ ਕਰਵਾਉਣਾ ਚਾਹੁੰਦਾ ਹਾਂ ਅਤੇ ਹੁਣ ਮੇਰੇ ਕੋਲ ਮੇਰੇ ਕੁਝ ਦੋਸਤ ਆ ਗਏ ਹਨ ਜਿਸ ਕਰਕੇ ਮੈਂ ਆਡਰ ਵੱਡਾ ਕਰਨਾ ਚਾਹੁੰਦਾ ਹਾਂ ਮੇਰੇ ਆਡਰ ਵਿੱਚ ਵਿੱਚ ਇੱਕ ਪੀਜੇ ਤੋਂ ਵਧਾ ਕੇ ਤਿੰਨ ਪੀਜੇ ਕਰ ਦੇਵੋ ਤਿੰਨ ਕੋਲਡ ਡਰਿੰਕ ਅਤੇ ਤਿੰਨ ਕੱਪ ਚਾਹ ਦੇ ਵੀ ਐਡ ਕਰ ਦੇਵੋ ਪੈਕਿੰਗ ਦਾ ਧਿਆਨ ਰੱਖਿਉ ਪੈਕਿੰਗ ਵਧੀਆ ਤਰੀਕੇ ਦੀ ਕਰੀ ਹੋਵੇ ਅਤੇ ਜਲਦੀ ਆਡਰ ਦੀ ਡਿਲੀਵਰੀ ਕੀਤੀ ਜਾਵੇ